ਪੰਜਾਬੀ ਭਾਸ਼ਾ ਦੀ ਵਰਤੋਂ ਸਾਹਿਤ ਕਵਿਤਾ ਅਤੇ ਕਲਾਤਮਕ ਪ੍ਰਗਟਾਵੇ ਵਿੱਚ ਕਈ ਰੂਪਾਂ ਵਿੱਚ ਕੀਤੀ ਜਾਂਦੀ ਹੈ ਕਵਿਤਾਵਾਂ ਵਿੱਚ ਭਾਸ਼ਾਂ ਭਾਵਾਂ ਭਾਵਨਾਵਾਂ ਨੂੰ ਗੁਲਜਨ ਲਈ ਵਿਵਿੱਧ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਸ਼ਬਦਾਂ ਵਾਕ ਅਤੇ ਅਖਤ ਵਰਤੇ ਜਾਂਦੇ ਹਨ ਇਹ ਵਰਤੋਂ ਵਿੱਚ ਲਹਿਰਾਵਾਂ ਅਲੰਕਾਰ ਅਤੇ ਛੰਨਾ ਵਰਤੀਆਂ ਜਾਂਦੀਆਂ ਹਨ ਜੋ ਕਵਿਤਾ ਨੂੰ ਰੰਗੀਨ ਬਣਾਉਂਦੀਆਂ ਹਨ ਸਾਹਿਤ ਦੇ ਰੂਪਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਨੂੰ ਸਾਹਿਤਕ ਰੂਪਾਂ ਵਿੱਚ ਵਰਤਣ ਦੇ ਕਈ ਰੂਪ ਹਨ ਕੁਝ ਮੁੱਖ ਰੂਪ ਇਸ ਵਿੱਚ ਇਹ ਸ਼ਾਮਿਲ ਹਨ ਕਿ ਕਵਿਤਾਵਾਂ ਵਿੱਚ ਭਾਸ਼ਾ ਅਤੇ ਭਾਵਨਾਵਾਂ ਨੂੰ ਸ਼ਬਦਾਂ ਦੀ ਮਪ ਮਦਦ ਨਾਲ ਪ੍ਰਗਟ ਕੀਤਾ ਜਾਂਦਾ ਹੈ ਇਹ ਵਿਚਾਰਧਾਰਾ ਅਤੇ ਅਦਾਕਾਰੀ ਦੀ ਵਰਤੋਂ ਹੁੰਦੀ ਹੈ ਜੋ ਕਿ ਆਧੁਨਿਕ ਜੀਵਨ ਅਤੇ ਸਮਾਜਿਕ ਮੁੱਦਿਆਂ ਨੂੰ ਪ੍ਰਵਿਤ ਕਰਦੀ ਹੈ ਉਪਨਾਮ ਵਿੱਚ ਕਿੱਥੇ ਲੋਕ ਜੀਵਨ ਅਤੇ ਸਮਾਜਿਕ ਮੁੱਦੇ ਨੂੰ ਉਲੀਖਿਆ ਜਾਂਦਾ ਹੈ ਅਤੇ ਲੋਕ ਕਥਾਵਾਂ ਵਿਰਾਸਤਾਂ ਅਤੇ ਆਤਮਿਕ ਸਫ਼ਰਾਂ ਦੀ ਵਰਤੋਂ ਕਰਦੇ ਹਨ ਇਹਨਾਂ ਵਿੱਚ ਛੋਟੀਆਂ ਸਿੱਖਿਆਂ ਸੁਣਦੇ ਅਤੇ ਇੱਕ ਛੋਟੇ ਪ੍ਰਕਾਰ ਵਰਤੀਆਂ ਜਾਂਦੀਆਂ ਹਨ ਇਹ ਅਕਸਰ ਜੀਵਨ ਅਤੇ ਸਮਾਜਿਕ ਮੁੱਦਿਆਂ 'ਤੇ ਚਿੰਤਾਮਨੀਆਂ ਵਿੱਚ ਗੱਭਰੂ ਹੁੰਦੀਆਂ ਹਨ ਨਾਟਕ ਨਾਟਕ ਵਿੱਚ ਵੇਖਿਆ ਅਤੇ ਪ੍ਰਦਰਸ਼ਨ ਦੁਆਰਾ ਸਮਾਜਿਕ ਮੁੱਦਿਆਂ ਅਤੇ ਵਿਚਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਵਿਆਖਿਆ ਅਤੇ ਵਿਆਦਾਂ ਨੂੰ ਤਬਦੀਲ ਕਰਨ ਅਤੇ ਸਮਾਜਿਕ ਪਰਿਸਥਿਤੀਆਂ ਨੂੰ ਪ੍ਰਕਾਸ਼ਿਤ ਕਰਦੇ ਹਨ ਇਹ ਸਭ ਰੂਪ ਪੰਜਾਬੀ ਭਾਸ਼ਾ ਦੇ ਸਾਹਿਤਕ ਧਾਰਾ ਨੂੰ ਵਿੱਚ ਅਤੇ ਵਿਵਿੱਧ ਬਣਾਉਣ ਦੀ ਅਤੇ ਸਮਾਜਿਕ ਅਧਿਕ ਅਤੇ ਧਾਰਮਿਕ ਸੰਦੇਸ਼ਾਂ ਨੂੰ ਲਈ ਸਾਧਨ ਬਣਦੇ ਹਨ ਪੰਜਾਬੀ ਭਾਸ਼ਾ ਦੀ ਕਵਿਤਾ ਰੂਪੀ ਵਿੱਚ ਵਰਤੋਂ ਦੇ ਤਰੀਕੇ ਭਾਵਨਾਤਮਕ ਤਰੀਕੇ ਇਸ ਤਰ੍ਹਾਂ ਦੇ ਕਵਿਤਾ ਵਿੱਚ ਕਈ ਆਪਣੇ ਭਾਵਨਾਵਾਂ ਦੇ ਦਲਿੱਦਰੀਆਂ ਨੂੰ ਵਿਆਕਰਣ ਕਰਦਾ ਹੈ ਅਤੇ ਸੁਣਨ ਵਾਲਿਆਂ ਦੇ ਦਿਲ ਨੂੰ ਛੂ ਲੈਂਦਾ ਹੈ ਸੋਸ਼ਲ ਕਵਿਤਾਵਾਂ ਇਹ ਕਵਿਤਾਵਾਂ ਸਮਾਜਿਕ ਮੁੱਦਿਆਂ ਸੰਘਰਸ਼ ਅਤੇ ਸੱਚਾਈ ਨੂੰ ਉਲੰਘਣ ਕਰਨ ਦੇ ਅਤੇ ਸਮਾਜਿਕ ਨੂੰ ਸੁਧਾਰਨ ਲਈ ਵਰਤੀਆਂ ਜਾਂਦੀਆਂ ਹਨ ਪ੍ਰੇਮ ਕਵਿਤਾਵਾਂ ਇਹ ਕਵਿਤਾਵਾਂ ਪ੍ਰੇਮ ਅਤੇ ਰੁਮਾਂਟਿਕ ਭਾਵਨਾਵਾਂ ਨੂੰ ਵਿਆਕਰਣ ਕਰਨ ਲਈ ਵਰਤੀਆਂ ਜਾਂਦੀਆਂ ਹਨ ਵਿਚਾਰ ਮੂਲ ਕਵਿਤਾਵਾਂ ਇਹ ਕਵਿਤਾਵਾਂ ਸੋਚ ਅਤੇ ਵਿਚਾਰ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਸਮਾਜਿਕ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਉਲੰਘਣ ਕਰਦੀ ਥਾਂ ਵਿੱਚ ਵਰਤੀਆਂ ਜਾਂਦੀਆਂ ਹਨ ਪੰਜਾਬੀ ਭਾਸ਼ਾ ਵਿੱਚ ਵਰਤੋਂ ਭਾਵੀ ਅਤੇ ਮਹੱਤਵਪੂਰਨ ਰੂਪ ਵਿੱਚ ਉਹਨਾਂ ਵਿਚਾਰਾਂ ਅਤੇ ਸਿਹਾਈਆਂ ਨੂੰ ਸਮਰਪਿਤ ਕਰਨ ਲਈ ਇੱਕ ਮੁੱਖਰ ਸਾਧਨ ਬਣਦੀ ਹੈ ਕਲਾਤਮਕ ਭਾਸ਼ਾ ਰੂਪੀ ਵਿੱਚ ਭਾਸ਼ਾ ਬੰਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬੀ ਭਾਸ਼ਾ ਵਿੱਚ ਕਲਾਤਮਕ ਪ੍ਰਗਟਾਵੇ ਨੂੰ ਵਰਤਣ ਲਈ ਵਿਵਿਦ ਰੂਪਾਂ ਹਨ ਜਿਨ੍ਹਾਂ ਵਿੱਚ ਕੁਝ ਮੁੱਖ ਸ਼ਾਮਿਲ ਹਨ ਚਿੱਤਰਕਾਰੀ ਪੰਜਾਬੀ ਕਲਾਕਾਰ ਵਿੱਚ ਚਿੱਤਰਕਾਰੀ ਅਤੇ ਰੰਗ ਰੰਗੋਲੀ ਦੇ ਕਿੱਤੇ ਅਤੇ ਕਲਾਤਮਕ ਰੰਗਾਂ ਦਿਖਾਈਆਂ ਜਾਂਦੀਆਂ ਹਨ ਜੋ ਭਾਵਾਂ ਵਿਚਾਰਾਂ ਨੂੰ ਰੰਗੀਨ ਬਣਾਉਂਦੀਆਂ ਹਨ ਸੰਗੀਤ ਭਾਸ਼ਾ ਪੰਜਾਬੀ ਭਾਸ਼ਾ ਅਤੇ ਗੀਤ ਸੰਗੀਤਾਂ ਨੂੰ ਧੁਨਾਂ ਦੀ ਰਚਨਾ ਅਤੇ ਪ੍ਰਸਤੁਤੀ ਕਈ ਕਲਾਤਮਕ ਪ੍ਰਗਟਾਵੇ ਦੇ ਸਾਧਨ ਹਨ ਨਾਟਕ ਪੰਜਾਬੀ ਨਾਟਕ ਵਿੱਚ ਅਦਾਕਾਰੀ ਅਤੇ ਵਿਆਖਿਆ ਦੇ ਮਾਧਿਅਮ ਨਾਲ ਨਾਟਕ ਦੇ ਕਲਾਤਮਕ ਪ੍ਰਗਟਾਵੇ ਨੂੰ ਸਮਰਪਿਤ ਹਨ ਪੰਜਾਬੀ ਦੇ ਫਿਲਮ ਇੰਡਸਟਰੀ ਇਸ ਵਿੱਚ ਮੂਲ ਰੂਪ 'ਤੇ ਆਉਂਦੀ ਹੈ ਧੰਨਵਾਦ